ਮੈਨੂੰ ਮਾਣ ਹੈ ਕਿ ਮੈਂ ਇੱਕ ਬਹੁਤ ਵਧੀਆ ਅਧਿਆਪਕਾ ਹਾਂ ਮੈਨੂੰ ਦੋ ਵਾਰ ਰਾਜ ਪੱਧਰੀ ਪੁਰਸਕਾਰ ਵੀ ਮਿਲ ਚੁੱਕਾ ਹੈ ਅਤੇ ਮੇਰੇ ਵਿਦਿਆਰਥੀ ਹਰ ਸਾਲ ਸਟੇਟ ਪੱਧਰੀ ਖੇਡਾਂ ਵਿੱਚ ਭਾਗ ਲੈਂਦੇ ਹਨ ਅਤੇ ਇਨਾਮ ਹਾਸਿਲ ਕਰਦੇ ਹਨ ਮੇਰੀਆਂ ਰਾਸ਼ਟਰੀ ਪੱਧਰ ਤੱਕ ਵੀ ਡਿਊਟੀਸ ਲੱਗੀਆਂ ਹੋਈਆਂ ਹਨ ਅਤੇ ਮੈਂ ਕਈ ਵਾਰ ਰੇਡੀਓ ਪ੍ਰੋਗਰਾਮ ਵੀ ਦਿੱਤੇ ਹੈ ਤਿੰਨ ਮਾਸਟਰ ਡਿਗਰੀਸ ਮੇਰੇ ਕੋਲ ਹਨ ਅਤੇ ਮੈਂ ਪੜ੍ਹ ਲਿਖ ਕੇ ਅਧਿਆਪਕਾ ਲੱਗੀ ਹਾਂ ਦੇਸ਼ ਦੀ ਸੇਵਾ ਕਰ ਰਹੀ ਹਾਂ ਮਾਤਾ ਪਿਤਾ ਦੀ ਸੇਵਾ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਕਰ ਰਹੀ ਹਾਂ ਮੈਨੂੁੰ ਬਹੁਤ ਮਾਣ ਹੈ ਕਿ ਮੈਂ ਆਪਣੀਆਂ ਇਹ ਸਾਰੀਆਂ ਡਿਊਟੀਸ ਬਾਖੂਬੀ ਨਿਭਾਅ ਰਹੀ ਹਾਂ